ਪੰਜਾਬ ਵਿੱਚ ਜਿਹੜੀਆਂ ਪ੍ਰਮੁੱਖ ਧਾਰਮਿਕ ਪਹਿਲਕਦਮੀਆਂ ਕਾਫੀ ਸੰਗਤਾਂ ਕਰਦੀਆਂ ਆਈਆਂ ਨੀਤੀਆਂ ਵੀ ਤਕਰੀਬਨ ਟਾਈਮ ਟੂ ਟਾਈਮ ਉਹੀ ਜੋ ਵੀ ਹੈ ਆਪਣੇ ਮਾਨਵਤਾ ਨਾਲ ਮਿਲਦੀਆਂ ਜੁਲਦੀਆਂ ਉਹਨਾਂ ਦਾ ਉਦੇਸ਼ ਅੰਤਰ ਧਰਮੀ ਸਦਭਾਵਨਾ ਨਾਲ ਵੀ ਚੱਲਦਾ ਸਹਿਯੋਗ ਵੀ ਕੀਤਾ ਜਾਂਦਾ ਜਿੱਦਾਂ ਵੱਖ ਵੱਖ ਤਿਉਹਾਰ ਮਤਲਬ ਸਿੱਖਿਆ ਦੇ ਨਾਲ ਹੋਰ ਸਮਾਜ ਸੇਵਾ ਦੇ ਨਾਲ ਸੰਬੰਧਿਤ ਅਤੇ ਇਹ ਟਾਈਮ ਟੂ ਟਾਈਮ ਮਤਲਬ ਗਾਈਡ ਕਰਦੇ ਆ ਸੰਗਤਾਂ ਨੂੰ ਹੋਰ ਆਪਣੇ ਜਿੰਨੇ ਵੀ ਅਗਾਂਹ ਵੱਧਦੇ ਹੈ ਤਕਰੀਬਨ ਧਾਰਮਿਕ ਪਹਿਲਕਦਮੀਆਂ ਦੇ ਵਿੱਚ ਇਨ੍ਹਾਂ ਨੇ ਜਿਵੇਂ ਕਿ ਵੱਖ ਵੱਖ ਧਰਮ ਵੀ ਹੈ ਸਾਡੇ ਦੇਸ਼ ਦੇ ਵਿੱਚ ਪੰਜਾਬ 'ਚ ਵੀ ਕਾਫੀ ਮਤਲਬ ਵੱਖਰੇ ਵੱਖਰੇ ਸਿਸਟਮ ਦੇਖਣ ਨੂੰ ਮਿਲਦੇ ਆ ਉਹਨਾਂ ਦੇ ਵਿੱਚ ਟਾਈਮ ਟੂ ਟਾਈਮ ਇਹ ਆਪਣੇ ਧਾਰਮਿਕ ਸਥਾਨ ਬਣਾਉਂਦੇ ਨੇ ਅਤੇ ਵੱਖ ਵੱਖ ਸੰਗਤਾਂ ਉੱਥੇ ਪਹੁੰਚਦੀਆਂ ਅਤੇ ਪਰਮਾਤਮਾ ਦੇ ਗੁਣ ਗਾਇਨ ਕਰਦੇ ਹੈ ਉਹਦੇ ਵਿੱਚ ਤਿਉਹਾਰ ਜਿੱਦਾਂ ਵਿਸਾਖੀ ਹੈ ਹੋਰ ਸਿੱਖਿਆ ਉਹਦੇ ਵਿੱਚ ਦੱਸਦੇ ਹੈ ਵੀ ਵਿਸਾਖੀ ਕਿਵੇਂ ਆਉਂਦੀ ਹੈ ਇਹ ਫਸਲ ਦੇ ਨਾਲ ਵੀ ਹੈ ਧਾਰਮਿਕ ਵੀ ਹੈ ਇਸ ਤਰ੍ਹਾਂ ਹੀ ਹੋਰ ਤਿਉਹਾਰ ਧਾਰਮਿਕ ਅਤੇ ਸਮਾਜ ਸੇਵਾ ਦੇ ਨਾਲ ਵੀ ਸੰਬੰਧਿਤ ਹੈ ਜਿਹੜੇ ਕਿ ਬੜੇ ਆਰਾਮ ਨਾਲ ਸੰਗਤਾਂ ਇਹ ਮਤਲਬ ਢੰਗ ਤਰੀਕੇ ਨਾਲ ਆਪਣਾ ਧਾਰਮਿਕ ਪਹਿਲਕਦਮੀਆਂ ਕਰਦੇ ਹੈ ਇਹਦੇ ਵਿੱਚ ਨੀਤੀਆਂ ਜਿਹੜੀਆਂ ਇਹ ਤਕਰੀਬਨ ਅੰਤਰ ਜਿਹੜਾ ਧਰਮੀ ਸਦਭਾਵਨਾ ਨਾਲ ਸਬੰਧਿਤ ਹੈ ਧੰਨਵਾਦ